ਪਿੰਡ ਵਿੱਚ ਬਿਜਲੀ ਨਾਲ਼ ਸਾਰੇ ਹੀ ਕੰਮ ਕੀਤੇ ਜਾਂਦੇ ਨੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹਰ ਇੱਕ ਚੀਜ਼ ਬਿਜਲੀ ਨਾਲ਼ ਚੱਲਣ ਵਾਲ਼ੀ ਹੈ ਘਰ ਵਿੱਚ ਪੱਖੇ ਫ਼ਰਿੱਜ ਵਾਸ਼ਿੰਗ ਮਸ਼ੀਨਾਂ ਸਭ ਕੁਛ ਬਿਜਲੀ ਨਾਲ਼ ਹੀ ਚੱਲਦਾ ਹੈ ਅਤੇ ਜਿਵੇਂ ਕਿ ਖੇਤੀਬਾੜੀ ਹੈ ਖੇਤੀਬਾੜੀ ਦੀ ਅੱਜ ਕੱਲ੍ਹ ਹਰ ਇੱਕ ਚੀਜ਼ ਹੀ ਬਿਜਲੀ 'ਤੇ ਡਿਪੈਨਡਿਡ ਹੈ ਬਿਜਲੀ ਨਾਲ਼ ਹੀ ਅੱਜ ਕੱਲ੍ਹ ਜੋ ਸਿੰਚਾਈ ਦਾ ਕੰਮ ਹੈ ਉਹ ਵੀ ਬਿਜਲੀ ਦੀ ਹੈਲਪ ਨਾਲ਼ ਮਦਦ ਨਾਲ਼ ਹੀ ਹੋ ਰਿਹਾ ਹੈ ਪਿੰਡ ਵਿੱਚ ਹਰ ਇੱਕ ਦੇ ਖੇਤਾਂ ਵਿੱਚ ਮੋਟਰਾਂ ਲੱਗੀਆ ਹੋਈਆਂ ਨੇ ਜਿਹਨਾਂ ਵਿੱਚ ਬਿਜਲੀ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਕਿਆ ਇਸ ਤੋਂ ਇਲਾਵਾ ਇਹ ਵੀ ਹੈ ਕਿ ਜਿਹੜੀ ਬਿਜਲੀ ਹੈ ਅੱਜ ਕੱਲ੍ਹ ਦੀ ਅੱਜ ਕੱਲ੍ਹ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਚੀਜ਼ ਹੈ ਤਕਰੀਬਨ ਤਕਰੀਬਨ ਕਾਫ਼ੀ ਤੋਂ ਵੱਧ ਚੀਜ਼ਾਂ ਬਿਜਲੀ 'ਤੇ ਹੀ ਨਿਰਭਰ ਹਨ